ਹੈਲੋ ਤੁਸੀਂ ਉਬਰ ਕੈਬ ਤੋਂ ਡਰਾਇਵਰ ਬੋਲ ਰਹੇ ਹੋ ਮੈਂ ਜਿਹੜੀ ਤੁਹਾਡੇ ਲਈ ਇੱਕ ਕੈਬ ਬੁੱਕ ਕਰਵਾਈ ਸੀ ਉਹ ਮੈਂ ਹੁਣ ਕੈਂਸਲ ਕਰ ਰਹੀ ਹਾਂ ਕਿਉਂਕਿ ਤੁਸੀਂ ਕਾਫੀ ਦੇਰੀ ਨਾਲ ਆਉਣਾ ਹੈ ਅਤੇ ਮੈਨੂੰ ਤੁਰੰਤ ਹੀ ਨਿਕਲਣਾ ਹੈ ਮੈਂ ਆਪਣਾ ਪ੍ਰਬੰਧ ਕਰ ਲਿਆ ਹੈ ਧੰਨਵਾਦ